ਹੈਲੋ ਮੈਂ ਸਿਮਰਪ੍ਰੀਤ ਸਿੰਘ ਬੋਲ ਰਿਹਾ ਹਾਂ ਕੀ ਤੁਸੀਂ ਸਵੀਗੀ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਨਾਲ ਇੱਕ ਕੰਪਲੇਂਟ ਸਾਂਝੀ ਕਰਨਾ ਚਾਹੁੰਦਾ ਹਾਂ ਮੈਂ ਪਟਿਆਲੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਜਦੋਂ ਔਫਿਸ ਵਿੱਚ ਹੁੰਦਾ ਹਾਂ ਤਾਂ ਮੈਂ ਕਈ ਵਾਰ ਤੁਹਾਡੇ ਐਪ ਤੋਂ ਸੂਪ ਜਾਂ ਹੋਟ ਕੌਫੀ ਔਡਰ ਕਰਦਾ ਹਾਂ ਮੈਂ ਪਿਛਲੇ ਦੋ ਤਿੰਨ ਵਾਰ ਤੋਂ ਦੇਖ ਰਿਹਾ ਹਾਂ ਕਿ ਜਦੋਂ ਮੈਂ ਸੂਪ ਹੋਟ ਕੌਫੀ ਜਾਂ ਕੋਈ ਹੋਰ ਗਰਮ ਪੀਣ ਵਾਲਾ ਪਦਾਰਥ ਮੰਗਵਾਉਂਦਾ ਹਾਂ ਤਾਂ ਉਹ ਠੰਡਾ ਹੋ ਹੋ ਜਾਂਦਾ ਹੈ ਉਸ ਦਾ ਸਵਾਦ ਠੰਡਾ ਹੋਣ ਕਾਰਨ ਖ਼ਰਾਬ ਹੋ ਜਾਂਦਾ ਹੈ ਅਤੇ ਮੈਨੂੰ ਇੰਝ ਲੱਗਦਾ ਹੈ ਕਿ ਮੇਰੇ ਪੈਸੇ ਬਰਬਾਦ ਹੋ ਗਏ ਨੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਪ੍ਰੋਡਕਟ ਪੈਕਜਿੰਗ ਉੱਤੇ ਅਤੇ ਉਸਦੀ ਡਿਲੀਵਰੀ ਉੱਤੇ ਉੱਤੇ ਖਾਸ ਧਿਆਨ ਦੇਵੋ ਤਾਂ ਜੋ ਉਹ ਅੱਗੇ ਤੋਂ ਗਰਮ ਹੀ ਰਹੇ ਅਤੇ ਠੰਡਾ ਹੋ ਕੇ ਉਸਦਾ ਸੁਆਦ ਨਾ ਵਿਗੜੇ ਕਿਉਂਕਿ ਮੈਂ ਅਤੇ ਮੇਰੇ ਵਰਗੇ ਕਈ ਗ੍ਰਾਹਕ ਇਸਦਾ ਸਾਹਮਣਾ ਕਰਦੇ ਹਨ ਅਤੇ ਜ਼ਿਆਦਾ ਵਾਰ ਐਦਾਂ ਹੋਣ 'ਤੇ ਉਹ ਦੂਸਰਾ ਕੰਪਨੀ ਤੋਂ ਮੰਗਵਾਉਣਾ ਪ੍ਰੈਫਰ ਕਰਨਗੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਸ ਨੈਗਟਿਵ ਰਿਵਿਊ ਨੂੰ ਮੰਨੋਗੇ ਅਤੇ ਕਹੀਆਂ ਗਈਆਂ ਗੱਲਾਂ ਉੱਤੇ ਖਾਸ ਧਿਆਨ ਦੇਵੋਗੇ ਮੈਂ ਤੁਹਾਡਾ ਧੰਨਵਾਦੀ ਹਾਂ